ਜੀ ਜਦ ਅਸੀਂ ਕਿਸੇ ਹੋਰ ਦੇਸ਼ ਵਿੱਚ ਘੁੰਮਣ ਫਿਰਨ ਲਈ ਜਾਂਦੇ ਹਾਂ ਤਾਂ ਉੱਥੇ ਸਾਨੂੰ ਭਾਸ਼ਾ ਦੀ ਮੁਸ਼ਕਲ ਕਾਫੀ ਪੇਸ਼ ਆਉਂਦੀ ਹੈ ਅਤੇ ਅੱਜ ਕੱਲ੍ਹ ਤਾਂ ਉਹ ਵੀ ਸੁਵਿਧਾ ਮਿਲ ਜਾਂਦੀ ਹੈ ਇੱਕ ਐਪ ਹੈ ਜਿਸਦਾ ਨਾਂ ਹੈ ਔਲ ਲੈਂਗੁਏਜਸ ਟਰਾਂਸਲੇਟਰ ਅਸੀਂ ਉਸ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਦੇਸ਼ ਵਿੱਚ ਜਾ ਕੇ ਆਪਣੀ ਭਾਸ਼ਾ ਨੂੰ ਉਹਨਾਂ ਦੀ ਭਾਸ਼ਾ ਵਿੱਚ ਬਦਲ ਸਕਦੇ ਹਾਂ

ਬੱਚਿਆਂ ਨੂੰ ਵਾਸਤੇ ਤਾਂ ਇਹ ਐਪ ਯੂਜ ਕਰਨੀ ਕਾਫੀ ਆਸਾਨ ਹੈ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਭ ਕੁਛ ਜਾਣਦੀ ਹੈ ਲੇਕਿਨ ਸਾਡੇ ਵਰਗੇ ਬਜ਼ੁਰਗਾਂ ਵਾਸਤੇ ਥੋੜ੍ਹੀ ਮੁਸ਼ਕਲ ਪੇਸ਼ ਆਉਂਦੀ ਹੈ ਫਿਰ ਅਸੀਂ ਆਪਣੇ ਬੱਚਿਆਂ ਦੀ ਮਦਦ ਨਾਲ ਅਸੀਂ ਵੀ ਉਸ ਐਪ ਦਾ ਫਾਇਦਾ ਉਠਾ ਸਕਦੇ ਹਾਂ ਅਤੇ ਇਹ ਐਪ ਕਾਫੀ ਸੁਵਿਧਾਜਨਕ ਹੈ ਕਿਤੇ ਬਾਹਰ ਜਦੋਂ ਅਸੀਂ ਕਿਸੇ ਵੀ ਦੇਸ਼ ਵਿੱਚ ਜਾਵਾਂਗੇ ਸ਼ੋਪਿੰਗ ਕਰਨੀ ਹੈ ਤਾਂ ਅਸੀਂ ਕਿਸੇ ਵੀ ਚੀਜ਼ ਦਾ ਮੁੱਲ ਜਾਂ ਉਸਦੇ ਉਸ ਬਾਰੇ ਅਸੀਂ ਜਾਣਕਾਰੀ ਆਪਣੀ ਭਾਸ਼ਾ ਵਿੱਚ ਬੋਲ ਕੇ ਉਹਨਾਂ ਦੀ ਭਾਸ਼ਾ ਰਾਹੀਂ ਸਮਝ ਜਾਵਾਂਗੇ ਇਸ ਤਰੀਕੇ ਨਾਲ ਇਹ ਐਪ ਕਾਫੀ ਸੁਵਿਧਾਜਨਕ ਹੈ ਹਾਂ ਅਸੀਂ ਵੀ ਇਸ ਐਪ ਨੂੰ ਯੂਜ ਕੀਤਾ ਹੈ ਜਦ ਅਸੀਂ ਚਾਈਨਾ ਘੁੰਮਣ ਵਾਸਤੇ ਗਏ ਸੀ ਉਸ ਵੇਲੇ ਸਾਡੇ ਵਾਸਤੇ ਇਹ ਕਾਫੀ ਸੁਵਿਧਾਜਨਕ ਐਪ ਸੀ ਧੰਨਵਾਦ